ਨਮਸਕਾਰ ਮੇਰਾ ਨਾਮ ਅਮਨ ਹੈ ਅਤੇ ਮੈਂ ਸੈਂਟਰਲ ਯੂਨੀਵਰਸਿਟੀ ਔਫ ਪੰਜਾਬ ਘੁੱਦਾ ਪਿੰਡ ਵਿੱਚ ਪੜ੍ਹਦੀ ਹਾਂ

ਅਤੇ ਮੈਂ ਕੱਲ੍ਹ ਸਵੇਰੇ ਨੌ ਵਜੇ ਉੱਥੇ ਪਹੁੰਚਣਾ ਹੈ ਜਿਸ ਕਰਕੇ ਮੈਨੂੰ ਅੱਜ ਰਾਤ ਨੂੰ ਬਠਿੰਡਾ ਤੋਂ ਦੇਰ ਰਾਤ ਵਾਲੀ ਟਰੇਨ ਫੜਨੀ ਪਵੇਗੀ ਤਾਂ ਜੋ ਮੈਂ ਅਗਲੇ ਦਿਨ ਸਵੇਰੇ ਸਮੇਂ ਸਿਰ ਇੰਟਰਵਿਊ ਲਈ ਪਹੁੰਚ ਸਕਾਂ ਅਤੇ ਕੀ ਕੋਈ ਔਟੋ ਜਾਂ ਕੈਬ ਉਪਲਬਧ ਹੈ ਜਿਹੜੀ ਦੇਰ ਰਾਤ ਮੈਨੂੰ ਬਠਿੰਡਾ ਰੇਲਵੇ ਸਟੇਸ਼ਨ 'ਤੇ ਪਹੁੰਚਾ ਸਕੇ ਟਰੇਨ ਦਾ ਸਮਾਂ ਲਗਭਗ ਇੱਕ ਡੇਢ ਵਜੇ ਦੇ ਕਰੀਬ ਹੈ ਤਾਂ ਅਤੇ ਮੈਂ ਬਾਰਾਂ ਵਜੇ ਮੈਨੂੰ ਕੈਬ ਦੀ ਜ਼ਰੂਰਤ ਹੈ ਜੇਕਰ ਕੋਈ ਵੀ ਕੈਬ ਉਪਲਬਧ ਹੈ ਤਾਂ ਕਿਰਪਾ ਕਰਕੇ ਮੈਨੂੰ ਉਸਦਾ ਫੋਨ ਨੰਬਰ ਦਿੱਤਾ ਜਾਵੇ ਅਤੇ ਪਿੱਕਅੱਪ ਸਥਾਨ ਘੁੱਦਾ ਪਿੰਡ ਸੈਂਟਰਲ ਯੂਨੀਵਰਸਿਟੀ ਔਫ ਪੰਜਾਬ ਹੈ